ਹਾਂਜੀ ਮੈਨੂੰ ਸਿੱਖਿਆ ਕਰਜ਼ਾ ਬਾਰੇ ਪਤਾ ਹੈ ਕਿ ਜਿਵੇਂ ਕਿਸੇ ਨੇ ਪੜ੍ਹਨਾ ਹੋਵੇ ਪਰ ਉਸ ਕੋਲ ਗੁੰਜਾਇਸ਼ ਨਾ ਹੋਵੇ ਉਸ ਦੇ ਮਾਤਾ ਪਿਤਾ ਨਾ ਖਰਚ ਕਰ ਸਕਦੇ ਹੋਣ ਤਾਂ ਉਹ ਇਹ ਕਰਜ਼ਾ ਲੈ ਕੇ ਪੜ੍ਹ ਸਕਦਾ ਹੈ ਜਿਵੇਂ ਮੇਰੇ ਇੱਕ ਜਾਣ ਪਛਾਣ ਵਿੱਚ ਸਨ ਉਹਨਾਂ ਕੋਲ ਪੈਸੇ ਨਹੀਂ ਸਨ ਪਰ ਉਹਨਾਂ ਦਾ ਬੱਚਾ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦਾ ਸੀ ਤਾਂ ਉਹਨਾਂ ਨੇ ਡਿਗਰੀ ਦੇ ਲਈ ਬੈਂਕ ਤੋਂ ਕਰਜ਼ਾ ਲਿਆ ਅਤੇ ਉਹਨਾਂ ਦੇ ਬੇਟੇ ਨੇ ਜਾ ਕੇ ਉੱਥੇ ਆਪਣੀ ਡਿਗਰੀ ਪੂਰੀ ਕੀਤੀ ਅਤੇ ਆਪਣਾ ਕੋਰਸ ਕੰਪਲੀਟ ਹੋਣ ਤੋਂ ਬਾਅਦ ਉਸ ਨੇ ਜੋ ਜਦੋਂ ਉਹ ਕੰਮ ਲੱਗ ਗਿਆ ਤਾਂ ਉਸ ਨੇ ਮਹੀਨੇ ਬਾਅਦ ਪੈਸੇ ਮੋੜਨੇ ਹਰ ਮਹੀਨੇ ਪੈਸੇ ਮੋੜਨੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਦਾ ਕਰਜ਼ਾ ਹੌਲੀ ਹੌਲੀ ਉੱਤਰ ਗਿਆ ਅਤੇ ਇਸ ਦੇ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਫਾਇਦਾ ਹੋਇਆ ਉਸ ਬੱਚੇ ਦਾ ਵੀ ਭਵਿੱਖ ਬਣ ਗਿਆ ਅਤੇ ਉਸ ਨੇ ਇਹ ਕਰਜ਼ਾ ਲੈ ਕੇ ਆਪਣੀ ਪੜ੍ਹਾਈ ਪੂਰੀ ਕਰ ਲਈ